ਹਾਂਜੀ ਜਿਹੜਾ ਵੀ ਕੁਛ ਅਸੀਂ ਆਪਣੇ ਹੱਥ ਦੇ ਨਾਲ ਅਸੀਂ ਕੁਛ ਬਣਾਉਂਦੇ ਹਾਂ ਉਸਦੀ ਇੱਕ ਵੱਖਰੀ ਹੀ ਗੱਲ ਹੁੰਦੀ ਹੈ ਵੈਸੇ ਤਾਂ ਬਜ਼ਾਰ ਤੋਂ ਸਭ ਕੁਛ ਮਿਲ ਜਾਂਦਾ ਹੈ ਲੇਕਿਨ ਇੱਕ ਵਾਰੀ ਮੈਂ ਆਪਣੀ ਇੱਕ ਫ਼ਰੈਡ ਨੂੰ ਇੱਕ ਗਿਫ਼ਟ ਦੇਣਾ ਸੀ ਤਾਂ ਉਸਦੇ ਲਈ ਮੈਂ ਖੁਦ ਆਪਣੇ ਹੱਥ ਦੇ ਨਾਲ ਇੱਕ ਬਹੁਤ ਹੀ ਅੱਛੀ ਇੱਕ ਮਤਲਬ ਮੂਰਤੀ ਅਸੀਂ ਤਿਆਰ ਕਰੀ ਹੈ ਜੋ ਕਿ ਉਸਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਔਰ ਉਸਨੂੰ ਬਣਾਉਣ ਦੇ ਵਿੱਚ ਮੈਨੂੰ ਬਹੁਤ ਅਨੰਦ ਆਇਆ ਔਰ ਮੇਰੀ ਫ਼ਰੈਂਡ ਨੇ ਵੀ ਉਸਨੂੰ ਬਹੁਤ ਪਸੰਦ ਕੀਤਾ